ਹੈਲੋ ਬੀ ਐਸ ਐਨ ਐਲ ਕੰਪਨੀ ਤੋਂ ਬੋਲ ਰਹੇ ਹਨ ਸਰ ਮੈਂ ਆਪਣਾ ਮੋਬਾਈਲ ਦਾ ਰੀਚਾਰਜ ਕਰ ਰਿਹਾ ਸੀ ਜਿਸ ਵਿੱਚ ਮੈਂ ਇੱਕ ਸਾਲ ਦੀ ਵੈਲਡੀਟੀ ਵਾਲਾ ਪਲੈਨ ਚੁਨਿਆ ਸੀ

ਮੇਰੇ ਤੋਂ ਗਲਤੀ ਨਾਲ ਇੱਕ ਮਹੀਨੇ ਵਾਲਾ ਪਲੈਨ ਦੀ ਰੀਚਾਰਜ ਹੋ ਗਿਆ ਮੇਰੀ ਰੀਚਾਰਜ ਆਈ ਡੀ ਰੀਚਾਰਜ ਆਈ ਡੀ ਟੂ ਥਰੀ ਫੌਰ ਸਿਕ੍ਸ ਨਾਇਨ ਏਟ ਟੂ ਫੌਰ ਥ੍ਰੀ ਫਾਈਵ ਹੈ ਕਿਰਪਾ ਕਰਕੇ ਇਸ ਦੀ ਜਾਂਚ ਕੀਤੀ ਜਾਵੇ ਅਤੇ ਜੋ ਮੇਰੇ ਵੱਲੋਂ ਇਕ ਸਾਲ ਦਾ ਰੀਚਾਰਜ ਕਰਵਾਇਆ ਜਾਣਾ ਸੀ ਉਸ ਦੇ ਬਦਲੇ ਇੱਕ ਮਹੀਨੇ ਦਾ ਰੀਚਾਰਜ ਮੇਰੇ ਵੱਲੋਂ ਕਰਵਾਇਆ ਗਿਆ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਮੇਰਾ ਇੱਕ ਮਹੀਨੇ ਵਾਲਾ ਰੀਚਾਰਜ਼ ਰੱਦ ਕਰਕੇ ਅਤੇ ਮੇਰੇ ਖਾਤੇ ਵਿੱਚ ਪੈਸੇ ਵਾਪਸ ਕਰਕੇ ਦੁਬਾਰਾ ਇੱਕ ਸਾਲ ਵਾਲੀ ਵੈਲਡਿਟੀ ਵਾਲਾ ਪਲੈਨ ਰੀਚਾਰਜ਼ ਕਰਨਾ ਚਉਂਦਾ ਹਾਂ ਕਿਰਪਾ ਕਰਕੇ ਮੇਰੀ ਇਸ ਕੀਤੀ ਹੋਈ ਬੇਨਤੀ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤਾਂ ਕਿ ਮੈਂ ਦੁਬਾਰਾ ਰੀਚਾਰਜ ਕਰਕੇ ਆਪਣੇ ਮੋਬਾਈਲ ਦੀ ਸੇਵਾ ਨੂੰ ਦੁਬਾਰਾ ਸ਼ੁਰੂ ਕਰ ਸਕਾਂ ਤੁਹਾਡਾ ਬਹੁਤ ਬਹੁਤ ਧੰਨਵਾਦ